ਸੈਰ ਸਪਾਟਾ ਸਾਡੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਵਿੱਚ ਕਈ ਤਰ੍ਹਾਂ ਮਦਦ ਕਰਦਾ ਹੈ ਜਿਵੇਂ ਕਿ ਰੋਜ਼ ਅਸੀਂ ਕਈ ਸਾਰੇ ਲੋਕਾਂ ਨਾਲ ਰੂਬਰੂ ਹੁੰਦੇ ਹਨ ਅਤੇ ਉਹਨਾਂ ਨੂੰ ਮਿਲ ਕੇ ਅਸੀਂ ਬਹੁਤ ਖੁਸ਼ ਮਹਿਸੂਸ ਕਰਦੇ ਹਨ ਕਿਉਂਕਿ ਉਹਨਾਂ ਵਿੱਚੋਂ ਕਈ ਤਾਂ ਸਾਡੇ ਆਲੇ ਦੁਆਲੇ ਦੇ ਲੋਕ ਹੀ ਹੁੰਦੇ ਹਨ ਉਹਨਾਂ ਨਾਲ ਮਿਲ ਕਰ ਅਸੀਂ ਕਈ ਸਾਰੀਆਂ ਗੱਲਾਂ ਕਰਦੇ ਹਨ ਕੋਈ ਖੁਸ਼ੀ ਦੀ ਗੱਲ ਹੁੰਦੀ ਹੈ ਅਤੇ ਜੇਕਰ ਕੋਈ ਦੁੱਖ ਦੀ ਗੱਲ ਹੋਵੇ ਤਾਂ ਅਸੀਂ ਉਹਨਾਂ ਨੂੰ ਸਹੂਲੀਅਤ ਦਿੰਦੇ ਹਨ ਅਤੇ ਜੇਕਰ ਕੋਈ ਹਾਸੇ ਦੀ ਗੱਲ ਹੋਵੇ ਤਾਂ ਅਸੀਂ ਜੋਰ ਜੋਰ ਦੀ ਹੱਸਦੇ ਵੀ ਹਨ ਅਸੀਂ ਅਤੇ ਕਈ ਇਸ ਤਰ੍ਹਾਂ ਦੀਆਂ ਹੋਰ ਗੱਲਾਂ ਵੀ ਹੁੰਦੀਆਂ ਹਨ ਅਸੀਂ ਰੋਜ਼ ਹੀ ਉਸ ਸਮੇਂ ਦਾ ਉਡੀਕ ਕਰਦੇ ਹਨ ਜਦੋਂ ਅਸੀਂ ਸੈਰ ਸਪਾਟਾ ਲਈ ਜਾਈਏ ਅਤੇ ਨਵੇਂ ਨਵੇਂ ਲੋਕਾਂ ਨਾਲ ਰੂਬਰੂ ਹੋਈਏ ਐਸੀ ਕਈ ਸਾਰੀਆਂ ਗੱਲਾਂ ਹੋਈਆਂ ਹਨ ਜਦੋਂ ਅਸੀਂ ਸੈਰ ਸਪਾਟੇ ਲਈ ਜਾਂਦੇ ਹਨ ਜੋ ਵੇਂ ਚੰਗੀਆਂ ਵੀ ਹਨ ਅਤੇ ਕਈ ਮਾੜੀਆਂ ਵੀ ਹੋਈਆਂ ਹਨ ਪਰ ਅਸੀਂ ਹਮੇਸ਼ਾ ਹੀ ਚੰਗੀ ਹੀ ਗੱਲਾਂ ਵੱਲ ਧਿਆਨ ਦਿੰਦੇ ਹਨ ਜਿਵੇਂ ਵੇਂ ਇੱਕ ਦਿਨ ਮੈਂ ਸੈਰ ਸਪਾਟੇ ਲਈ ਗਿਆ ਸੀ ਤਾਂ ਗਲਤੀ ਨਾਲ ਮੇਰਾ ਚਸ਼ਮਾ ਸੜਕ ਦੇ ਉੱਤੇ ਹੀ ਡਿੱਗ ਗਿਆ ਅਤੇ ਮੈਂ ਧਿਆਨ ਨਹੀਂ ਦਿੱਤਾ ਪਿੱਛੇ ਆ ਰਹੇ ਸੈਲਾਨੀ ਨੇ ਉਹ ਦੇਖ ਲਿਆ ਅਤੇ ਮੇਰਾ ਚਸ਼ਮਾ ਮੈਨੂੰ ਵਾਪਸ ਮੋੜ ਦਿੱਤਾ ਅਤੇ ਕਿਹਾ ਕਿ ਜਰਾ ਧਿਆਨ ਰੱਖਿਆ ਕਰੋ ਅਤੇ ਜਦੋਂ ਅਸੀਂ ਹੋਰ ਗੱਲਬਾਤ ਕੀਤੀ ਤਾਂ ਮੈਨੂੰ ਪਤਾ ਲੱਗਿਆ ਕਿ ਉਹ ਮੇਰੇ ਆਲੇ ਦੁਆਲੇ ਹੀ ਰਹਿੰਦਾ ਹੈ ਇਸ ਤਰ੍ਹਾਂ ਅਸੀਂ ਦੋਵਾਂ ਦੀ ਜਾਣ ਪਛਾਣ ਹੋ ਗਈ ਅਤੇ ਹੁਣ ਅਸੀਂ ਦੋਵੇਂ ਇਕੱਠੇ ਹੀ ਸੈਰ ਸਪਾਟਾ ਕਰਦੇ ਹਨ